ਮੈਂ ਅਕਸਰ ਹੀ ਮੈਰਾਥੋਨ ਦੀ ਤਿਆਰੀ ਕਰਦੀ ਰਹਿੰਦੀ ਹਾਂ ਅਤੇ ਮੈਂ ਸੁਬ੍ਹਾ ਸ਼ਾਮ ਆਪਣਾ ਯੋਗਾ ਅਤੇ ਮੈਰਾਥੋਨ ਲਈ ਲੰਬੀ ਜਾਂ ਘੱਟ ਦੂਰੀ ਦੀਆਂ ਰੇਸਾਂ ਲਈ ਤਿਆਰੀ ਕਰਦੀ ਰਹਿੰਦੀ ਹਾਂ ਅਤੇ ਮੈਂ ਕਾਫੀ ਦੌੜਾਂ ਦੌਰਾਨ ਕਾਫੀ ਮੈਡਲ ਵੀ ਜਿੱਤੇ ਹਨ ਜਿਸ ਕਰਕੇ ਮੇਰਾ ਬਹੁਤ ਵਧੀਆ ਅਨੁਭਵ ਬਣਿਆ ਹੋਇਆ ਹੈ ਅਤੇ ਇਸ ਦੀ ਤਿਆਰੀ ਲਈ ਮੇਰੇ ਕੁਝ ਇਸ ਪ੍ਰਕਾਰ ਦੇ ਪੜਾਅ ਹਨ ਤਿਆਰੀ ਦੇ ਪੜਾਅ ਲਕਸ਼ ਦਾ ਨਿਰਧਾਰਨ ਆਪਣੇ ਉਦੇਸ਼ ਨੂੰ ਸਮਝੋ ਕੀ ਤੁਸੀਂ ਸਿਰਫ ਮੈਰਾਥੋਨ ਪੂਰਾ ਕਰਨ ਲਈ ਜਾਂ ਵਧੀਆ ਸਮਾਂ ਲੈਣ ਲਈ ਤਿਆਰ ਕਰ ਰਹੇ ਹੋ ਮੈਰਾਥੋਨ ਦੀ ਤਰੀਕ ਅਤੇ ਥਾਂ ਦੀ ਜਾਣਕਾਰੀ ਲਵੋ ਯੋਜਨਾ ਬਣਾਓ ਸੋਲ੍ਹਾਂ ਜਾਂ ਵੀਹ ਹਫ਼ਤਿਆਂ ਦੀ ਤਿਆਰੀ ਲਈ ਯੋਜਨਾ ਬਣਾਓ ਜੋ ਦੌੜਾਂ ਸਪੀਡ ਵਰਕ ਅਤੇ ਰੈਸਟ ਦਿਨਾਂ ਨੂੰ ਸ਼ਾਮਿਲ ਕਰੇ ਹਫ਼ਤੇ ਵਿੱਚ ਚਾਰ ਪੰਜ ਦੌੜਾਂ ਰੱਖੋ ਜਿੱਥੇ ਇੱਕ ਲੰਬੀ ਦੌੜ ਹੋਵੇ ਫਿਟਨੈਸ ਖ ਸਤਰ ਜੇ ਤੁਸੀਂ ਨਵੇਂ ਦੌੜਨ ਵਾਲੇ ਹੋ ਤਾਂ ਪਹਿਲਾਂ ਪੰਦਰ੍ਹਾਂ ਕਿਲੋਮੀਟਰ ਜਾਂ ਦਸ ਕਿਲੋਮੀਟਰ ਦੀ ਦੌੜਾਂ 'ਤੇ ਕੰਮ ਕਰੋ ਦੀਰੇ ਦੀਰੇ ਦੂਰੀ ਵਧਾਉਣਾ ਦੌੜਨ ਦੀ ਦੂਰੀ ਨੂੰ ਹਰ ਹਫ਼ਤੇ ਦਸ ਪ੍ਰਤੀਸ਼ਤ ਤੱਕ ਵਧਾਓ ਸਪੀਡ ਅਤੇ ਇੰਟਰਵਲ ਵਰਕ ਸਪੀਡ ਵਰਕ ਵਿੱਚ ਚਾਰ ਸੌ ਮੀਟਰ ਦੇ ਇੰਟਰਵਲ ਸ਼ਾਮਿਲ ਕਰੋ ਜੋ ਤੁਹਾਡੀ ਸਪੀਡ ਨੂੰ ਬਿਹਤਰ ਕਰਨ ਵਿੱਚ ਮਦਦ ਕਰੇਗਾ ਹਫ਼ਤੇ ਵਿੱਚ ਇੱਕ ਦੋ ਦਿਨ ਸਪੀਡ ਟਰੇਨਿੰਗ ਲਈ ਰੱਖੋ ਲੰਬੀ ਦੌੜ ਹਫ਼ਤੇ ਦੇ ਅੰਤ ਦੇ ਇੱਕ ਲੰਬੀ ਦੌੜ ਕਰੋ ਜਿਸ ਨਾਲ ਤੁਹਾਡੇ ਸਰੀਰ ਨੂੰ ਲੰਬੀ ਦੂਰੀ ਦੇ ਲਈ ਤਿਆਰ ਕਰਨ ਵਿੱਚ ਮਦਦ ਮਿਲੇਗੀ ਪੋਸ਼ਣ ਸਿਹਤਮੰਦ ਖੁਰਾਕ ਕਾਰਬੋਹਾਈਡਰੇਟ ਪ੍ਰੋਟੀਨ ਅਤੇ ਵਿਟਾਮਿਨਾਂ ਨੂੰ ਸਹੀ ਮਾਤਰਾ ਵਿੱਚ ਖਾਓ ਦੌੜ ਤੋਂ ਪਹਿਲਾਂ ਅਤੇ ਦੌੜ ਦੌਰਾਨ ਪਾਣੀ ਅਤੇ ਇਲੈਕਟਰੋਨਲਾਈਟਸ ਦੀ ਮਦਦ ਨੂੰ ਯਕੀਨੀ ਬਣਾਓ ਆਰਾਮ ਅਤੇ ਸੁਸਤ ਹੋਣਾ ਸਮਾਂ ਸਮਾਂ 'ਤੇ ਰੈਸਟ ਦਿਨ ਰੱਖੋ ਤਾਂ ਜੋ ਮਾਸਪੇਸ਼ੀਆਂ ਨੂੰ ਵਧੀਆ ਬਣਾਉਣ ਦਾ ਸਮਾਂ ਮਿਲੇ ਨੀਂਦ ਨੂੰ ਬਿਹਤਰ ਬਣਾਉਣ ਦੇ ਧਿਆਨ ਦਿਓ ਕਿਉਂਕਿ ਇਹ ਮੁਹੱਈਆ ਗੁਣਵੱਤਾ ਲਈ ਜ਼ਰੂਰੀ ਹੈ ਮੈਂਟਲ ਦੀ ਤਿਆਰੀ ਮੈਰਾਥੋਨ ਦੀ ਮੈਨੋ ਵੈ ਵਿਗਿਆਨਿਕ ਤਿਆਰੀ ਦੌਰਾਨ ਜਿੰਨੇ ਲੰਮੇ ਸਮੇਂ ਤੱਕ ਮੁਸ਼ਕਿਲ ਪਲ ਆਉਂਦੇ ਰਹਿੰਦੇ ਹਨ ਉਹਨਾਂ ਨੂੰ ਸੰਭਾਲਣ ਲਈ ਵੀ ਤਿਆਰੀ ਕਰੋ ਸੰਤੁਸ਼ਟੀ ਦੇ ਤਰੀਕੇ ਜਿਵੇਂ ਕਿ ਧਿਆਨ ਕਰਨ ਜਾਂ ਦੌੜ ਦੌਰਾਨ ਮਨੋਰੰਜਨ ਸੰਗੀਤ ਸੁਣਨਾ